ਸਰ ਮੈਂ ਮਿਰਾਜ ਵਾਰਿਸ ਹਾਂ ਸਰ ਮੈਂ ਤੁਹਾਡੇ ਖਾਲਸਾ ਸਟੈਂਡ ਤੋਂ ਕੈਬ ਬੁੱਕ ਕਰਵਾਈ ਸੀਗੀ ਅਤੇ ਅਸੀਂ ਪੰਜ ਮੁੰਡੇ ਜਾਣਾ ਸੀਗਾ ਘੁੰਮਣ ਰੋਪੜ ਤੋਂ ਜਲੰਧਰ ਅਤੇ ਉਹ 'ਚ ਮੇਰੇ ਇੱਕ ਦੋਸਤ ਨੂੰ ਇਮਰਜੈਂਸੀ ਪੈ ਗਈ ਅਤੇ ਉਹਨੂੰ ਜ਼ਰੂਰੀ ਕੰਮ ਪੈ ਗਿਆ ਫਿਰ ਉਹਨੇ ਜਾਣਾ ਨਹੀਂ ਹੁਣ ਫਿਰ ਇਸ ਕਰਕੇ ਸਾਡਾ ਸਾਰੇ ਬੰਦਿਆਂ ਦਾ ਟੂਰ ਕੈਂਸਲ ਹੋ ਗਿਆ ਅਸੀਂ ਪੰਜ ਮੁੰਡੇ ਸੀਗੇ ਮੈਂ ਸੀਗਾ ਮਿਰਾਜ ਵਾਰਿਸ ਸੰਤੋਸ਼ ਮਨੀਸ਼ ਅਤੇ ਆਦੀ ਹੋਰ ਵੀ ਦੋ ਹੋਰ ਸੀਗੇ ਅਤੇ ਅਸੀਂ ਸਾਰਿਆਂ ਨੇ ਹੁਣ ਜਾਣਾ ਨਹੀਂ ਕਿਉਂਕਿ ਸਾਡੇ ਇੱਕ ਦੋਸਤ ਨੂੰ ਇਮਰਜੈਂਸੀ ਕੋਲ ਆ ਗਿਆ ਸੀਗਾ ਫਿਰ ਉਹਨੇ ਕੈਂਸਲ ਕਰਾ ਤਾ ਫਿਰ ਕਿਰਪਾ ਕਰਕੇ ਸਾਡਾ ਕੈਬ ਬੁੱਕਿੰਗ ਰੱਦ ਕਰ ਦਿਉ ਅਸੀਂ ਹੁਣ ਜਾਣਾ ਨਹੀਂ ਕਿਸੇ ਨੇ ਫਿਰ ਘੁੰਮਣ ਫਿਰ ਜਿਹੜੇ ਮੈਂ ਔਨਲਾਈਨ ਪੇਮੈਂਟ ਕੀਤੇ ਸੀਗੇ ਤੁਹਾਨੂੰ ਉਹ ਵੀ ਸਾਡਾ ਵਾਪਸ ਕਰ ਦਿਉ ਕਿਰਪਾ ਕਰਕੇ ਜ ਜਿਹੜੇ ਥੋੜ੍ਹੇ ਬਹੁਤ ਪੇਮੈਂਟ ਕੀਤੀ ਸੀਗੀ ਮੈਂ ਅਤੇ ਮੇਰਾ ਜਿਹੜਾ ਕੈਬ ਹੈ ਉਹ ਕੈਂਸਲ ਕਰ ਦਿਉ ਅਸੀਂ ਹੁਣ ਜਾਣਾ ਨਹੀਂ ਘੁੰਮਣ